ਮੈਂ ਸ਼ੀਤਲ ਕੁਮਾਰੀ ਮਿਰਜ਼ਾਪੁਰ ਪ੍ਰਵਾਸੀ ਜਿਲ੍ਹਾ ਪਠਾਨਕੋਟ ਦੀ ਰਹਿਣ ਵਾਲੀ ਹਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਅੱਜ ਕੱਲ੍ਹ ਦੇ ਸਮੇਂ ਮੁਤਾਬਿਕ ਸੜਕ ਸੁਰੱਖਿਆ ਦੇ ਨਿਯਮ ਕੀ ਹਨ ਜੇਕਰ ਆਪਾਂ ਛੋਟੇ ਤੋਂ ਛੋਟਾ ਵਾਹਨ ਦੀ ਗੱਲ ਕਰੀਏ ਸਾਈਕਲ ਦੀ ਤਾਂ ਉਸ ਦੇ ਨਿਯਮ ਕੀ ਹਨ ਸਭ ਤੋਂ ਪਹਿਲਾ ਸਾਨੂੰ ਸਾਈਕਲ ਚਲਾਉਣਾ ਕਿਸੇ ਖ਼ਾਸ ਜਗ੍ਹਾਂ 'ਤੇ ਸਿੱਖਣਾ ਚਾਹੀਦਾ ਹੈ ਕਿਸੇ ਖੇਡ ਦੇ ਮੈਦਾਨ ਵਿੱਚ ਜਾ ਕੇ ਰਸਤਿਆਂ ਵਿੱਚ ਜਿਹਨਾਂ ਵਿੱਚ ਕੋਈ ਟ੍ਰੈਫ਼ਿਕ ਦੇ ਆਸਾਰ ਘੱਟ ਹੋਣ ਜੇਕਰ ਅਸੀ ਸਾਈਕਲ ਚਲਾਉਣਾ ਸਿੱਖ ਲਿਆ ਹੈ ਤਾਂ ਉਸ ਦਾ ਸਾਂਭ ਸਭ ਤੋਂ ਪਹਿਲਾ ਨਿਯਮ ਇਹ ਹੈ ਕਿ ਸਦਾ ਖੱਬੇ ਹੱਥ ਚਲਾਉਣਾ ਚਲਾਉਣਾ ਅਤੇ ਆਪਣੇ ਸਾਈਕਲ ਦੀ ਰਫ਼ਤਾਰ ਨੂੰ ਆਪਣੇ ਕੰਟਰੋਲ ਵਿੱਚ ਰੱਖਣਾ ਜੇਕਰ ਅਸੀ ਸਮੇਂ ਸਮੇਂ ਦੇ ਮੁਤਾਬਿਕ ਇਹ ਗੱਲ ਵੱਲ ਧਿਆਨ ਦਿਆਂਗੇ ਤਾਂ ਕਦੇ ਵੀ ਸਾਨੂੁੰ ਸਾਈਕਲ ਚਲਾਉਣ ਵਿੱਚ ਪਰੇਸ਼ਾਨੀ ਨਹੀ ਆਏਗੀ ਅਸੀ ਇਹ ਗੱਲ ਕਰੀਏ ਕਹਿ ਸਕਦੇ ਹਾਂ ਕਿ ਸਾਈਕਲ ਚਲਾਉਣ ਦੇ ਨਿਯਮ ਅਤੇ ਕਾਨੂੰਨ ਸਾਨੂੰ ਸੜਕ ਸੁਰੱਖਿਆਂ ਵਿੱਚ ਹੀ ਪਤਾ ਲੱਗਦੇ ਹਨ ਜੇਕਰ ਅਸੀ ਇਹਨਾਂ ਦੇ ਕਾਗਜ਼ਾਂ ਦੀ ਗੱਲ ਕਰੀਏ ਤਾਂ ਇਹ ਗੱਲ ਬੜੀ ਹੀ ਵਧੀਆ ਹੈ ਕਿ ਪੁਰਾਣੇ ਸਮੇਂ ਵਿੱਚ ਜਿਸ ਤਰ੍ਹਾਂ ਜੰਮੂ ਕਸ਼ਮੀਰ ਵਿੱਚ ਜਾ ਕੇ ਕਿਸੇ ਦੂਜੇ ਰਾਜ ਵਿੱਚ ਜਾਣ ਲੱਗਿਆਂ ਸਾਈਕਲ ਦੇ ਪਰਮੈਨਟ ਹੁੰਦੇ ਹਨ ਪਰ ਅੱਜ ਉਹ ਸਮਾਂ ਬਦਲ ਗਿਆ ਹੈ ਸਾਇਕਲ ਦਾ ਕੋਈ ਵੀ ਕਾਗਜ਼ ਨਹੀਂ ਹੁੰਦਾ ਸਾਇਕਲ ਦੀ ਨਾ ਆਰ ਸੀ ਹੁੰਦੀ ਹੈ ਨਾ ਇਸ ਦੀ ਡਰਾਈਵਿੰਗ ਲਾਇਸੈਂਸ ਦੀ ਜ਼ਰੂਰਤ ਹੈ ਪਰ ਜੇਕਰ ਅਸੀਂ ਸਮੇਂ ਦੇ ਮੁਤਾਬਿਕ ਗੱਲ ਕਰੀਏ ਤਾਂ ਸਾਡੇ ਕੋਲ ਸਾਈਕਲ ਚਲਾਉਣ ਲੱਗਿਆਂ ਵੀ ਡਰਾਈਵਿੰਗ ਲਾਇਸੈਂਸ ਦੀ ਜ਼ਰੂਰਤ ਹੁੰਦੀ ਹੈ ਜ਼ਰੂਰਤ ਹੁੰਦੀ ਹੈ ਸਾ ਸਾਨੂੰ ਹਮੇਸ਼ਾ ਹੀ ਡਰਾਈਵਰੀ ਲਾਇਸੈਂਸ ਕੋਲ ਰੱਖਣਾ ਚਾਹੀਦਾ ਹੈ ਜਿਸ ਨਾਲ ਸਾਨੂੰ ਕੋਈ ਪੁੱਛੇ ਤਾਂ ਅਸੀਂ ਉਸ ਨੂੰ ਇਹ ਪੇਸ਼ ਕਰ ਸਕੀਏ ਕਿ ਸਾਡੇ ਕੋਲ ਇਹ ਕਾਗਜ਼ ਹੈ ਜਿਹੜਾ ਕਿ ਅਸੀਂ ਆਪਣੇ ਕੋਲ ਸੰਭਾਲ ਕੇ ਰੱਖਿਆ ਹੈ ਚਲਾਉਣ ਵਾਸਤੇ ਵੀ ਸਾਨੂੰ ਡਰਾਈਵਿੰਗ ਲਾਇਸੈਂਸ ਅਤੇ ਹੋਰ ਕਈ ਕਾਗਜ਼ ਦੀ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ